ਸਾਡੇ ਖੇਤਰ ਦੇ ਲੋਕ ਪੰਜਾਬੀ ਅਤੇ ਹਿੰਦੀ ਆਦਿ ਭਾਸ਼ਾਵਾਂ ਬੋਲਦੇ ਹਨ ਜੋ ਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਅਤੇ ਪੰਜਾਬੀ ਭਾਸ਼ਾ ਵਿੱਚ ਹੋਰ ਵੀ ਭਾਸ਼ਾਵਾਂ ਜਿਵੇਂ ਕਿ ਮਾਝੀ ਮਾਲਵੀ ਦੁਆਬੀ ਪੁਆਧੀ ਆਦਿ ਬੋਲੇ ਜਾਂਦੀਆਂ ਹਨ ਅਤੇ ਇਹ ਹਰ ਹਰ ਪੱਚੀ ਤੀਹ ਕਿਲੋਮੀਟਰ ਬਾਅਦ ਬਦਲਦੀਆਂ ਜਾਂਦੀਆਂ ਹਨ ਅਤੇ ਮਾਝੀ ਮਾਲਵੀ ਪੁਆਧੀ ਦੁਆਬੀ ਆਦਿ ਦੇ ਅਲੱਗ ਆਦਿ ਭਾਸ਼ਾਵਾਂ ਦੇ ਵਿਅਕਤੀ ਅਲੱਗ ਅਲੱਗ ਭਾਸ਼ਾਵਾਂ ਬੋਲਦੇ ਜਿਵੇਂ ਕਿ ਮਾਝੇ ਵਾਲ਼ਿਆਂ ਦੀ ਮਾਝੇ ਵਾਲ਼ਿਆਂ ਦੀ ਭਾਸ਼ਾ ਥੋੜ੍ਹੀ ਅਲੱਗ ਹੁੰਦੀ ਹੈ ਅਤੇ ਮਲਵਈ ਵਾਲ਼ਿਆਂ ਦੀ ਥੋੜ੍ਹੀ ਭ ਭਾਸ਼ਾ ਉਨ੍ਹਾਂ ਤੋਂ ਡਿਫਰੈਂਟ ਹੁੰਦੀ ਹੈ ਅਤੇ ਦੁਆਬੀ ਪੁਆਧੀ ਇਨ੍ਹਾਂ ਦੀ ਵੀ ਭਾਸ਼ਾਵਾਂ ਉਨ੍ਹਾਂ ਭਾਸ਼ਾਵਾਂ ਤੋਂ ਥੋੜ੍ਹੀ ਥੋੜ੍ਹੀ ਅਲੱਗ ਹੁੰਦੀ ਹੈ